ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਰੋਜ਼ਗਾਰ ਅਤੇ ਰੋਜ਼ੀ ਰੋਟੀ ਦੇ ਬਹੁਤ ਸਾਰੇ ਸ੍ਰੋਤ ਹਨ ਖੇਤੀਬਾੜੀ ਉਦਯੋਗ ਸੇਵਾਵਾਂ ਅਤੇ ਸਵੈ ਰੋਜ਼ਗਾਰ ਨਾਲ ਸੰਬੰਧਿਤ ਵੀ ਲੋਕ ਕਿੱਤੇ ਕਰਦੇ ਹਨ ਖਾਸ ਤੌਰ 'ਤੇ ਜਿੱਦਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਇਸੇ ਤਰ੍ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਵੀ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਸੰਬੰਧਿਤ ਹੀ ਕਿੱਤੇ ਕਰਦੇ ਹਨ ਜਿੱਥੇ ਖੇਤੀਬਾੜੀ ਦੇ ਨਾਲ ਨਾਲ ਉਦਯੋਗਿਕ ਖੇਤਰ ਵੀ ਇੱਥੇ ਹੈ ਨੇ ਜਿੱਥੇ ਲੋਕ ਉਦਯੋਗ ਦੇ ਵਿੱਚ ਵੀ ਰੋਜ਼ਗਾਰ ਪ੍ਰਾਪਤ ਕਰਦੇ ਆ ਉਸ ਦੇ ਨਾਲ ਨਾਲ ਸਵੈ ਰੋਜ਼ਗਾਰ ਦੇ ਜਿਸ ਤਰ੍ਹਾਂ ਡਾਇਰੀ ਦਾ ਹੋ ਗਿਆ ਪਮ ਪੋਲਟਰੀ ਫਾਰਮ ਦਾ ਹੋ ਗਿਆ ਪਸ਼ੂ ਪਾਲਣ ਦੇ ਧੰਦੇ ਵੀ ਲੋਕਾਂ ਵੱਲੋਂ ਕੀਤੇ ਜਾਂਦੇ ਹਨ ਜਿਸ ਤਰ੍ਹਾਂ ਦੇਸ਼ ਜਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਸਮੱਸਿਆ ਹੈ ਇਸ ਤਰ੍ਹਾਂ ਇਸ ਜ਼ਿਲ੍ਹੇ ਦੇ ਵਿੱਚ ਵੀ ਹੈ ਪਰ ਜ਼ਿਆਦਾਤਰ ਲੋਕ ਇਸ ਖਿੱਤੇ ਦੇ ਇਸ ਜ਼ਿਲ੍ਹੇ ਦੇ ਅ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਜਿਹੜੇ ਲੋਕ ਹੈ ਉਹ ਜ਼ਿਆਦਾਤਰ ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਵਾਸਤੇ ਅ ਜਾਂਦੇ ਨੇ ਅਤੇ ਜਾਣਾ ਪੈਂਦਾ ਹੈ ਅਤੇ ਜੇ ਖੇਤੀ ਅ ਜਾਂ ਉਦਯੋਗਾਂ ਦੇ ਹੋਰ ਵੀ ਮੌਕੇ ਮਿਲਣ ਤਾਂ ਲੋਕਾਂ ਲਈ ਆਪਣਾ ਜੀਵਨ ਸੁਖਾਲਾ ਅਤੇ ਲੋਕਲੀ ਜਿਹੜਾ ਉਹਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ